ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਜੀ ਹਾਂਜੀ ਮੇਰਾ ਨਾਮ ਜਸਮੀਤ ਸਿੰਘ ਹੈ ਜੀ ਹਾਂਜੀ ਜੀ ਸਾਡੀ ਸੋਸਾਇਟੀ ਹਾਂਜੀ ਹਾਂਜੀ ਉਰੇ ਚੌਵੀ ਘੰਟੇ ਪਾਣੀ ਉਪਲਬਧ ਰਹਿੰਦਾ ਹੈ ਜੀ ਨਹੀਂ ਜੀ ਨਹੀਂ ਜੇਕਰ ਕੋਈ ਸਮੱਸਿਆ ਆ ਵੀ ਜਾਵੇ ਤਾਂ ਸਾਡੇ ਆਪਣੇ ਖੁਦ ਦੇ ਇਲੈਕਟ੍ਰੀਸ਼ਨ ਹਨ ਜੀ ਇਸ ਦੇ ਅੱਠ ਫਲੋਰ ਨੇ ਜੀ ਜੀ ਇਕ ਬੀ ਐੱਚ ਕੇ ਦਾ ਰੈਂਟ ਪੰਜ ਤੋਂ ਸੱਤ ਹਜ਼ਾਰ ਰੁਪਏ ਹੈ ਅਤੇ ਦੋ ਬੀ ਐੱਚ ਕੇ ਦਾ ਦਸ ਤੋਂ ਬਾਰ੍ਹਾਂ ਹਜ਼ਾਰ ਰੁਪਏ ਜੀ ਤੀਹ ਤੋਂ ਪੈਂਤੀ ਲੱਖ ਵੰਨ ਬੀ ਐੱਚ ਕੇ ਦਾ ਅਤੇ ਜੀ ਚਾਲੀ ਤੋਂ ਪੰਜਾਹ ਲੱਖ ਟੂ ਬੀ ਐੱਚ ਕੇ ਦਾ ਹੈ ਜੀ ਹਾਂਜੀ ਘੱਟ ਜਾਂਦਾ ਹੈ ਜੀ ਜਿਉਂ ਜਿਉਂ ਆਪਾਂ ਉੱਪਰ ਨੂੰ ਜਾਈ ਜਾਂਦੇ ਹਾਂ ਤਾਂ ਰੇਟ ਘੱਟਦਾ ਜਾਂਦਾ ਹੈ ਜੀ ਹਾਂਜੀ ਜੀ ਸਾਡੇ ਫਲੈਟਾਂ ਵਿੱਚ ਸਭ ਤੋਂ ਉੱਤਲੇ ਫਲੋਰ 'ਤੇ ਸਵੀਮਿੰਗ ਪੂਲ ਵੀ ਹੈ ਜੀ ਅਤੇ ਜਿੰਮ ਵੀ ਫ੍ਰੀ ਹੈ ਜੀ ਅਤੇ ਪਾਰਕਿੰਗ ਵਾਸਤੇ ਸਭ ਨੂੰ ਆਪਣੀ ਆਪਣੀ ਪਾਰਕਿੰਗ ਦਿੱਤੀ ਹੋਈ ਹੈ ਜੋ ਕਿ ਸਾਡੇ ਸਾਰੇ ਯੂਸ ਕਰ ਸਕਦੇ ਹਨ ਜੀ ਹਾਂਜੀ ਅੰਦਰ ਸਾਡੇ ਕੋਲ ਹਰੇਕ ਆਈਟਮਾਂ ਦੀ ਸ਼ੋਪ ਵੀ ਹੈ ਜੀ ਤੁਹਾਨੂੰ ਬਾਹਰ ਜਾਣ ਦੀ ਕੋਈ ਲੋੜ ਨਹੀਂ ਤੁਸੀਂ ਸਾਡੇ ਸੋਸਾਇਟੀ ਦੇ ਅੰਦਰੋਂ ਹੀ ਸਭ ਕੁਛ ਕਰਿਆਨਾ ਕੱਪੜੇ ਕੋਈ ਵੀ ਸ਼ੋਪਿੰਗ ਕਰ ਸਕਦੇ ਹੋ ਜੀ ਪਾਰਕਿੰਗ ਦਾ ਜੀ ਹਰੇਕ ਫਲੈਟ ਦੇ ਜੋ ਮਾਲਕ ਹਨ ਜੀ ਉਹਨਾਂ ਨੂੰ ਆਪਣੀ ਹੀ ਪਾਰਕਿੰਗ ਦਿੱਤੀ ਹੋਈ ਹੈ ਬਲੋਕ ਨੇ ਜੀ ਹਰੇਕ ਬਲੋਕ ਵਿੱਚ ਆਪਣੀ ਆਪਣੀ ਲੋਕ ਪਾਰਕਿੰਗ ਲਗਾ ਸਕਦੇ ਹਨ ਤਾਂ ਕਿ ਅੱਗੇ ਜਾ ਕੇ ਕੋਈ ਕਿਸੇ ਨੂੰ ਦਿੱਕਤ ਜਾਂ ਪਰੇਸ਼ਾਨੀ ਨਾ ਆਵੇ ਧੰਨਵਾਦ ਜੀ ਮੇਰਾ ਨਾਮ ਜਸਮੀਤ ਸਿੰਘ ਹੈ ਜੀ ਠੀਕ ਹੈ ਜੀ